ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਕੀ ਸਹਾਇਤਾ ਕਰ ਸਕਦੀ ਹਾਂ ਤੁਹਾਡੀ ਮੈਮ ਜਲੰਧਰ ਨੂੰ ਵੀ ਜਾਂਦੀ ਆ ਹੁਸ਼ਿਆਰਪੁਰ ਨੂੰ ਵੀ ਜਾਂਦੀ ਹੈ ਇੱਧਰ ਲੁਧਿਆਣੇ ਨੂੰ ਦਿੱਲੀ ਮੋਹਾਲੀ ਇੱਦਾਂ ਸਾਰੀ ਸਾਈਡ ਨੂੰ ਜਾਂਦੀਆਂ ਨੇ ਮੈਮ ਪੈਸੈਂਜਰ ਦਾ ਦੋ ਸੌ ਰੁਪਈਆ ਏ ਜੇ ਤੁਸੀਂ ਏਸੀ ਦਾ ਕਰਾਉਂਦੇ ਹੋ ਉਹਦਾ ਪੰਜ ਸੌ ਹੈ ਅਤੇ ਦਾ ਵੀ ਛੇ ਸੌ ਰੁਪਈਆ ਹੈ ਦਿੱਲੀ ਲਈ ਅਲੱਗ ਚਾ ਅਲੱਗ ਚਾਰਜਿਜ਼ ਨੇ ਕਿਉਂਕਿ ਉੱਧਰ ਦਾ ਟਾਈਮ ਜ਼ਿਆਦਾ ਲੱਗਦਾ ਹੈ ਉਹਦੇ ਲਈ ਜਿਹੜਾ ਪੈਸੈਨਜਰ ਹੈ ਉਹਦਾ ਪੰਜ ਸੌ ਰੁਪਈਆ ਹੈ ਜੇ ਲੁਧਿਆਣੇ ਨੂੰ ਜਾਣਾ ਤਾਂ ਉਹਦੇ ਲਈ ਤਾਂ ਤੁਹਾਡਾ ਉੱਧਰ ਵੀ ਦੋ ਸੌ ਰੁਪਈਆ ਲੱਗੇਗਾ ਕਿਉਂਕਿ ਉਹਦੇ ਵੀ ਜਿਹੜੀ ਘੱਟ ਹੀ ਦੂਰੀ ਆ ਉਹ ਥੋੜ੍ਹੀ ਦੂਰੀ 'ਤੇ ਹੀ ਹੈ ਏਸੀ ਦਾ ਤੁਹਾਡਾ ਪੰਜ ਸੌ ਲੱਗੇਗਾ ਮੈਮ

ਉੱਧਰ ਨੂੰ ਥੋੜ੍ਹੇ ਚਾਰਜਿਸ ਵੱਧ ਨੇ ਉੱਧਰ ਨੂੰ ਤਿੰਨ ਸੌ ਲੱਗੇਗਾ ਤੁਹਾਡਾ ਪੈਸੈਂਜਰ ਦਾ ਅਤੇ ਏਸੀ ਦਾ ਛੇ ਸੌ ਲੱਗੇਗਾ ਜੇ ਮੈਮ ਤੁਸੀਂ ਬੁਕਿੰਗ ਕਰਾਉਂਦੇ ਹੋ ਫਿਰ ਤਾਂ ਤੁਹਾਡਾ ਮਿਲੇਗਾ ਤੁਹਾਨੂੰ ਜੇ ਤੁਸੀਂ ਨਹੀਂ ਕਰਾਉਂਦੇ ਹੋ ਫਿਰ ਨਹੀਂ ਮਿਲਦਾ ਹਾਂਜੀ ਸਟੇਸ਼ਨ 'ਤੇ ਸਭ ਕੁਝ ਪ੍ਰੋਵਾਈਡ ਹੁੰਦਾ ਹਾਂਜੀ ਹਾਂਜੀ ਮੈਮ ਕਲੀਨ ਹੈ ਮੈਮ ਸਾਰੀਆਂ ਸੁਵਿਧਾਵਾਂ ਉਪਲਬਧ ਨੇ ਟ੍ਰੇਨ 'ਚ ਸਾਡੀ 'ਚ ਠੀਕ ਹੈ ਮੈਮ ਠੀਕ ਹੈ ਮੈਮ ਕਿੰਨਾਂ ਦੇ ਨਾਂ 'ਤੇ ਕਰਾਂ ਠੀਕ ਹੈ ਜੀ ਠੀਕ ਹੈ ਜੀ ਕਿਹੜੀ ਟਾਈਮਿੰਗ ਦੀ ਕਰਨੀ ਹੈ ਸ਼ਾਮ ਦੀ ਸਵੇਰ ਦੀ ਠੀਕ ਹੈ ਮੈਮ ਠੀਕ ਹੈ ਸ਼ਾਮ ਪੰਜ ਵਜੇ ਦੀ ਟਿਕਟ ਹੈ ਤੁਹਾਡੀ

ਓਕੇ ਮੈਮ ਥੈਂਕ